ਜਦੋਂ ਵੀ ਮੈਂ ਦੌੜਨ ਵਾਸਤੇ ਜਾਂਦੀ ਹਾਂ ਰਨਿੰਗ ਵਾਸਤੇ ਜਾਂਦੀ ਹਾਂ ਤਾਂ ਮੈਨੂੰ ਉਸ ਸਮੇਂ ਆਪਣੇ ਆਪ ਨੂੰ ਕੋਸੰਟਰੇਟ ਕਰਨ ਵਾਸਤੇ ਥੋੜ੍ਹਾ ਜਿਹਾ ਮਿਊਜ਼ਿਕ ਸੁਣਨਾ ਪਸੰਦ ਹੈ ਅਤੇ ਮੈਂ ਜਿਹੜੀ ਹਾਂ ਉਹ ਪੁਰਾਣੇ ਗਾਣੇ ਬਹੁਤ ਹੀ ਜ਼ਿਆਦਾ ਪਸੰਦ ਕਰਦੀ ਹਾਂ ਅਤੇ ਮੈਂ ਉਹੀ ਜ਼ਿਆਦਾਤਰ ਸ ਸੁਣਦੀ ਹਾਂ ਕਿਉਂਕਿ ਮੈਨੂੰ ਉਹਨਾਂ ਨੂੰ ਸੁਣਨ ਨਾਲ਼ ਥੋੜ੍ਹਾ ਜਿਹਾ ਰਿਲੈਕਸ ਮਹਿਸੂਸ ਹੁੰਦਾ ਏ ਅਤੇ ਮੈਨੂੰ ਬਹੁਤ ਹੀ ਵਧੀਆ ਲੱਗਦਾ ਏ